ਵੀਹ ਅਗਸਤ ਉੱਨੀ ਸੌ ਬਿਆਸੀ ਪੰਜ ਸਤੰਬਰ ਉੱਨੀ ਸੌ ਸਤੱਤਰ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਬਾਈ ਜੁਲਾਈ ਉੱਨੀ ਸੌ ਛਿਆਸੀ ਇਕ ਜਨਵਰੀ ਦੋ ਹਜ਼ਾਰ ਚੌਦਾਂ